ਭੋਜਨ ਸਾਡੀ ਜ਼ਿੰਦਗੀ ਦਾ ਮੂਲ ਆਧਾਰ ਹੈ ਮੈਨੂੰ ਭੋਜਨ ਬਦਾ ਬਣਾਉਂਣ ਦਾ ਬਹੁਤ ਸ਼ੌਂਕ ਹੈ ਮੈਂਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਬਣਾਉਂਣੇ ਆਉਂਦੇ ਹਨ ਜਿਵੇਂ ਕਿ ਸ਼ੁਰੀਆ ਪੂਰੀਆਂ ਛੋਲੇ ਗੋਲ ਗੱਪੇ ਟਿੱਕੀ ਵਗੈਰਾ ਜਿਹੜੇ ਕਿ ਸਭ ਨੂੰ ਬਹੁਤ ਪਸੰਦ ਆਉਂਦੇ ਹਨ ਮੈਂ ਘਰ ਦੀ ਰਸੋਈ ਵਿੱਚ ਘਰ ਦੀ ਰਸੋਈ ਵਿੱਚ ਪੂਰੇ ਤਨ ਮਨ ਨਾਲ ਬਹੁਤ ਹੀ ਸਵਾਦਿਸ਼ਟ ਭੋਜਨ ਬਣਾਉਂਦੀ ਹਾਂ ਜਿਹੜਾ ਕਿ ਸਾਡੀ ਫੈਮ ਪਰਿਵਾਰ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਮੈਂ ਆਸ ਪਾਸ ਦੇ ਲੋਕਾਂ ਨੂੰ ਵੀ ਮੇਰਾ ਹੱਥ ਦਾ ਬਣਿਆ ਖਾਣਾ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਇਸ ਲਈ ਮੈਂ ਯੂਟਿਊਬ 'ਤੇ ਆਪਣੀ ਆਪਣਾ ਇੱਕ ਚੈਨਲ ਬਣਾਇਆ ਅਤੇ ਮੈਂ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਦੀ ਹਾਂ ਖਾਣੇ ਦੀ ਮੇਰੇ ਜਿਹੜਾ ਹੱਥ ਦਾ ਬਣਿਆ ਹੋਇਆ ਖਾਣਾ ਉਹ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਅਤੇ ਮੈਂ ਚਾਹੁੰਦੀ ਹਾਂ ਕਿ ਕਿਉਂਕਿ ਅਸੀ ਸਾਰਾ ਖਾਣਾ ਜਿਹੜਾ ਔਰਗੈਨਿਕ ਚੀਜ਼ਾਂ ਨਾਲ ਹੀ ਬਣਾਉਂਦੇ ਹਾਂ ਇਹਦੇ ਵਿੱਚ ਕੋਈ ਵੀ ਮਿਲਾਵਟ ਵਾਲੀ ਚੀਜ਼ ਨਹੀਂ ਹੁੰਦੀ ਇਸ ਲਈ ਸਾਡਾ ਖਾਣਾ ਸ਼ੁੱਧ ਅਤੇ ਸ਼ੁੱਧ ਅਤੇ ਸਹੀ ਬਣਦਾ ਹੈ ਇਹਦੇ ਨਾਲ ਜਿਹੜੀ ਹੈਲਥ ਆ ਉਹ ਵੀ ਠੀਕ ਰਹਿੰਦੀ ਹੈ ਤਾਂ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਸੀ ਵੀ ਭੋਜਨ ਦੀਆਂ ਜਿਹੜੇ ਭੋਜਨ ਬਣਾਉਣ ਦੇ ਤਰੀਕੇ ਸਿੱਖ ਸਕੋ ਤਾਂ ਜੋ ਤੁਹਾਡੀ ਵੀ ਸਿਹਤ ਆ ਜਿਹੜੀ ਉਹ ਸਿਹਤਮੰਦ ਰਹੇ ਅਤੇ ਤੁਸੀਂ ਬਾਹਰ ਤਲਿਆ ਹੋਇਆ ਖਾਣਾ ਖਾ ਕੇ ਆਪਣੀ ਸਿਹਤ ਨੂੰ ਖਰਾਬ ਨਾ ਕਰੋ ਇਸ ਲਈ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀ ਰੋਜ਼ ਨਵੇਂ ਨਵੇਂ ਭੋਜਨ ਬਣਾਉਣੇ ਸਿੱਖ ਸਕੋ ਅਤੇ ਆਪਣੀ ਸਿਹਤ ਨੂੰ ਠੀਕ ਰੱਖ ਸਕੋ